ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਮੈਂ ਸੁਖਵਿੰਦਰ ਸਿੰਘ ਜੀ ਨਾਲ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਜੀ ਮੈਂ ਨਾ ਇੱਕ ਸਵੀਗੀ ਤੋਂ ਨਾ ਇੱਕ ਕੁਛ ਮੰਗਵਾਇਆ ਸੀ ਹਾਂਜੀ ਹਾਂਜੀ ਸਵੀਗੀ ਤੋਂ ਹੀ ਮੰਗਵਾਇਆ ਸੀ ਹਾਂਜੀ ਮੇਰਾ ਨਾਮ ਨਾ ਜੋਤੀ ਕੌਰ ਆ ਅਤੇ ਮੈਂ ਤੁਹਾਨੂੰ ਪਾਰਸਲ ਨੰਬਰ ਮੇਰਾ ਇੱਕ ਮਿੰਟ ਮੈਂ ਤੁਹਾਨੂੰ ਨਾ ਵੇਖ ਕੇ ਦੱਸਦੀ ਹਾਂ ਹਾਂਜੀ ਛਿਆਲੀ ਬਿਆਲੀ ਮੇਰਾ ਪਾਰਸਲ ਨੰਬਰ ਸੀ ਹਾਂਜੀ ਮੈਨੂੰ ਨਾ ਕਾਫੀ ਚਿਰ ਹੋ ਗਿਆ ਮੈਂ ਨਾ ਸਵੀਗੀ ਤੋਂ ਔਡਰ ਕੀਤੀ ਸੀ ਦਾਲ ਮੱਖਣੀ ਕੁਲਚੇ ਅਤੇ ਰਾਜਮਾਂਹ ਚਾਵਲ ਅਤੇ ਕਾਫੀ ਸਮਾਂ ਹੋ ਗਿਆ ਆ ਪਰ ਮੈਨੂੰ ਹਜੇ ਤੱਕ ਨਾ ਪਾਰਸਲ ਨਹੀਂ ਆਇਆ ਹੋਇਆ ਜੇ ਹਾਂਜੀ ਹਾਂਜੀ ਹਾਂਜੀ ਮੈਨੂੰ ਲੱਗਦਾ ਕਿ ਸ਼ਾਇਦ ਨਾ ਕਿਤੇ ਉਹਨਾਂ ਨੂੰ ਮੈਂ ਨਾ ਗਲਤ ਐਡਰੈਸ ਭੇਜ ਦਿੱਤਾ ਸੀ ਅਤੇ ਸ਼ਾਇਦ ਉਹ ਇਸ ਕਰਕੇ ਉਹਨਾਂ ਨੂੰ ਨਾ ਮਿਲ ਨਹੀਂ ਰਿਹਾ ਹਾਂਜੀ ਮੈਂ ਤੁਹਾਨੂੰ ਹੁਣ ਨਾ ਆਪਣਾ ਇਕ ਨਵਾਂ ਐਡਰੈਸ ਦੇ ਦਿੰਦੀ ਹਾਂ ਮੇਰਾ ਘਰ ਦਾ ਨੰਬਰ ਤਿੰਨ ਸੌ ਚਾਰ ਅਤੇ ਜੋ ਜੋ ਹੈਗਾ ਨਾ ਵਾਲਮੀਕੀ ਚੌਂਕ ਉਹਦੇ ਲਾਗੇ ਆ ਅਤੇ ਮੇਰੇ ਘਰ ਦੇ ਸਾਹਮਣੇ ਹੀ ਨਾ ਇੱਕ ਬੜਾ ਵੱਡਾ ਪਿੱਪਲ ਦਾ ਪੇੜ ਆ ਅਤੇ ਉਹਦੇ ਲਾਗੇ ਕਾਫੀ ਗੱਡੀਆਂ ਖੜ੍ਹੀਆਂ ਰਹਿੰਦੀਆਂ ਆ ਹਾਂਜੀ ਅਤੇ ਉਹ ਉੱਥੇ ਪਹੁੰਚਾ ਦਿਓ ਹਾਂਜੀ ਹਾਂਜੀ